ਵੱਡੇ ਖੇਤੀਬਾੜੀ ਕਾਰੋਬਾਰ ਨੇ ਜਿਹੜੇ ਆਪਣੇ ਵੱਡੇ ਵੱਡੇ ਕਿਸਾਨ ਨੇ ਉਹ ਛੋਟੇ ਕਿਸਾਨਾਂ 'ਤੇ ਕਈ ਵਾਰੀ ਭਾਰੀ ਪੈ ਜਾਂਦੇ ਨੇ ਜਿਵੇਂ ਕਿ ਉਹਨਾਂ ਕੋਲ ਪਹਿਲਾਂ ਜ਼ਮੀਨ ਘੱਟ ਹੁੰਦੀ ਹੈ ਠੀਕ ਹੈ ਛੋਟੇ ਕ ਛੋਟੇ ਕਿਸਾਨ ਨੇ ਜਿਹੜੇ ਉਹਨਾਂ ਨੂੰ ਕੰਮ ਵੀ ਖੁਦ ਕਰਨਾ ਪੈਂਦਾ ਵੱਡੇ ਖੇਤੀਬਾੜੀ ਵਾਲੇ ਨੇ ਉਹ ਦਿਹਾੜੀਆਂ 'ਤੇ ਜਾਂ ਮਸ਼ੀਨਾਂ ਰਾਹੀਂ ਜੋ ਅੱਜ ਕੱਲ੍ਹ ਮਸ਼ੀਨੀ ਯੁੱਗ ਚੱਲ ਪਿਆ ਉਹਦੇ ਰਾਹੀਂ ਖੇਤੀ ਨੂੰ ਨੂੰ ਕਰ ਦਿੰਦੇ ਫਿਰ ਉਹਨਾਂ ਦਾ ਵਪਾਰੀ ਵਪਾਰੀ ਵੀ ਉਹਨਾਂ ਦੇ ਪਹੁੰਚ ਖੁਦ ਕਰਦੇ ਨੇ ਉਹਨਾਂ ਨੂੰ ਕਿਤੇ ਫਸਲ ਵੇਚਣ ਲਈ ਜਾਂ ਫਸਲ ਖਰੀਦਣ ਲਈ ਬੀ ਵਗੈਰਾ ਲਈ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਗੱਲ ਕਰੀਏ ਸੰਦਾਂ ਦੀ ਵੱਡੇ ਕਿਸਾਨਾਂ ਕੋਲ ਵੱਡੇ ਸੰਦ ਨੇ ਸੌਖੀਆਂ ਸਹੂਲਤਾਵਾਂ ਨੇ ਪਾਣੀ ਦੇ ਕਨੈਕਸ਼ਨ ਵੱਧ ਨੇ ਛੋਟੇ ਕਿਸਾਨਾਂ ਨੂੰ ਨਾ ਪਾਣੀ ਪੂਰਾ ਆਉਂਦਾ ਹੈ ਨਾ ਹੀ ਉਹਨਾਂ ਦੀ ਵਪਾਰੀਆਂ ਕੋਲ ਕੋਈ ਪੁੱਛ ਗਿੱਛ ਹੁੰਦੀ ਹੈ ਅਤੇ ਨਾ ਹੀ ਉਹਨਾਂ ਕੋਲ ਕੋਈ ਸੰਦ ਹੁੰਦੇ ਨੇ ਉਹ ਹੱਥੀਂ ਆਪਣੀ ਖੇਤੀਬਾੜੀ ਨੂੰ ਅੱਗੇ ਵਧਾਉਂਦੇ ਨੇ ਜਿਹਨਾਂ ਕਰਕੇ ਜਿਹੜੇ ਵੱਡੇ ਖੇਤੀਬਾੜੀ ਕਿਸਾਨ ਨੇ ਉਹ ਛੋਟੇ ਨਾਲੋਂ ਜਲਦੀ ਵਿਕਾਸ ਕਰਦੇ ਨੇ